ਸਤਿ ਸ਼੍ਰੀ ਅਕਾਲ ਸਰ ਸਰਦਾਰ ਫੋਨਸ ਤੋਂ ਬੋਲਦੇ ਆਂ ਭਾਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਮੈਂ ਲਗਭਗ ਦਸ ਪੰਦਰਾਂ ਦਿਨ ਪਹਿਲਾਂ ਨਾ ਤੁਹਾਡੀ ਦੁਕਾਨ ਤੋਂ ਇੱਕ ਫੋਨ ਲਿੱਤਾ ਸੀ ਨਵਾਂ ਤੇ ਰੀਅਲ ਮੀ ਮੋਡਲ ਸੀ ਤੇ ਮੈਂ ਆਪਣੇ ਪਿਤਾ ਜੀ ਵਾਸਤੇ ਲਿੱਤਾ ਸੀ ਸਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਫੋਨ ਬਹੁਤ ਵਧੀਆ ਚੱਲ ਰਿਹਾ ਤੇ ਇਸ ਵਿੱਚ ਕੋਈ ਵੀ ਤਕਨੀਕੀ ਜਾਂ ਕੋਈ ਹੋਰ ਵੀ ਚੀਜਾਂ ਨਾ ਕੁਛ ਵੀ ਇਹੋ ਜਿਹਾ ਨੀ ਹੋਇਆ ਤੇ ਫੋਨ ਬਹੁਤ ਵਧੀਆ ਚੱਲ ਰਿਹਾ ਤੇ ਮੈਂ ਆਪਣੇ ਪਿਤਾ ਜੀ ਵਾਸਤੇ ਖਰੀਦਿਆ ਸੀ ਤੇ ਮੇਰੇ ਪਿਤਾ ਜੀ ਦੀ ਥੋੜੀ ਉਮਰ ਜਿਆਦਾ ਐ ਪਰ ਉਹਨਾਂ ਨੂੰ ਦੇਖਣ ਵਿੱਚ ਵੀ ਥੋੜੀ ਤਕਲੀਫ਼ ਐ ਪਰ ਫੋਨ ਵਿੱਚ ਜੋ ਅੱਖਰਾਂ ਦਾ ਜੋ ਸਾਈਜ਼ ਐ ਉਹ ਵੱਡਾ ਹੋਣ ਕਰਕੇ ਉਹਨਾਂ ਨੂੰ ਕੋਈ ਤਕਲੀਫ਼ ਨੀ ਹੋ ਰਹੀ ਤੇ ਬਹੁਤ ਵਧੀਆ ਫੋਨ ਚੱਲ ਰਿਹਾ ਤੇ ਮੈਂ ਇਸਦੀ ਸ਼ਲਾਘਾ ਕਰਦਾ ਹਾਂ ਤੇ ਮੈਂ ਆਸ ਕਰਦਾ ਹਾਂ ਕੀ ਤੁਸੀਂ ਅੱਗੇ ਵੀ ਮੈਂ ਇੱਕ ਫੋਨ ਹੋਰ ਨਵਾਂ ਖਰਦੀਣਾ ਆਪਣੇ ਮਾਤਾ ਜੀ ਵਾਸਤੇ ਤੇ ਮੈਨੂੰ ਆਸ ਐ ਤੁਸੀਂ ਇਸ ਤਰ੍ਹਾਂ ਹੀ ਮੈਨੂੰ ਅਗਲਾ ਫੋਨ ਵੀ ਦੇਓਗੇ ਤਾਂ ਇਹ ਮੈਂ ਤੁਹਾਡਾ ਬਹੁਤ ਈ ਧੰਨਵਾਦੀ ਰਹਾਂਗਾ